ਅਠਾਰ੍ਹਾਂ ਨਵੰਬਰ ਵੀਹ ਸੌ ਤੇਈ ਚਾਰ ਅਪ੍ਰੈਲ ਵੀਹ ਸੌ ਤੇਈ ਦਸ ਮਈ ਵੀਹ ਸੌ ਤੇਈ ਛੇ ਜੂਨ ਵੀਹ ਸੌ ਤੇਈ ਅੱਠ ਅਗਸਤ ਵੀਹ ਸੌ ਤੇਈ